ਯੋਗ ਦਾ ਸਾਡੇ ਹੁਣ ਦੇ ਲਗਾਤਾਰ ਵਿਅਸਤ ਜੀਵਨ ਦੇ ਵਿੱਚ ਬੜਾ ਮਹੱਤਵ ਹੈ ਇਸ ਦੇ ਲਈ ਭਾਰਤ ਸਰਕਾਰ ਵੱਲੋਂ ਵੀ ਯੋਗ 'ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਜਿਹੜਾ ਯੋਗ ਹੈ ਉਹ ਸਾਨੂੰ ਮਾਨਸਿਕ ਅਤੇ ਸਰੀਰਕ ਦੋਨਾਂ ਪੱਖਾਂ ਤੋਂ ਹੀ ਮਜ਼ਬੂਤ ਬਣਾਉਣ ਲਈ ਬੜਾ ਵਧੀਆ ਵਸੀਲਾ ਹੈ ਅਸੀਂ ਯੋਗ ਦੇ ਰਾਹੀਂ ਆਪਣੇ ਸਰੀਰ ਨੂੰ ਵੀ ਤੰਦਰੁਸਤ ਰੱਖਦੇ ਹਾਂ ਅਤੇ ਮਾਨਸਿਕ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਯੋਗ ਤੋਂ ਵਧੀਆ ਹੋਰ ਕੋਈ ਵੀ ਦਵਾਈ ਨਹੀਂ ਹੈ ਜਾਂ ਵਰਜਿਸ਼ ਨਹੀਂ ਹੈ ਇਸ ਲਈ ਰੋਜ਼ਾਨਾ ਜੀਵਨ ਵਿੱਚ ਯੋਗ ਦੀ ਬੜੀ ਮਹੱਤਤਾ ਹੈ ਇਹ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਸਾਡੀਆਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ ਕਿਉਂਕਿ ਹੁਣ ਦੇ ਸਮੇਂ ਵਿੱਚ ਬਿਮਾਰੀਆਂ ਬਹੁਤ ਵੱਡੇ ਪੱਧਰ 'ਤੇ ਵੱਧ ਚੁੱਕੀਆਂ ਹਨ ਬਿਮਾਰੀਆਂ ਦੇ ਕਰਕੇ ਅਸੀਂ ਰੋਜ਼ਾਨਾ ਬੜਾ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਾਂ ਆਪਣਾ ਸਰੀਰਕ ਅਤੇ ਮਾ ਪੈਸੇ ਪੱਖੋਂ ਵੀ ਨੁਕਸਾਨ ਕਰਵਾ ਰਹੇ ਹਾਂ ਪਰ ਯੋਗ ਰਾਹੀਂ ਅਸੀਂ ਇਸ ਨੂੰ ਸੁਧਾਰ ਸਕਦੇ ਹਾਂ ਇਸ ਨੂੰ ਵਧੀਆ ਬਣਾ ਸਕਦੇ ਹਾਂ ਸੋ ਸਾਨੂੰ ਰੋਜ਼ਾਨਾ ਜੀਵਨ ਵਿੱਚ ਯੋਗਾ ਕਰਨਾ ਚਾਹੀਦਾ ਹੈ ਇਸ ਦੀ ਅਭਿਆਸ ਕਰਨਾ ਚਾਹੀਦਾ ਹੈ ਸਰਕਾਰਾਂ ਵੀ ਯੋਗ ਦੇ ਸੈਂਟਰ ਖੋਲ੍ਹ ਰਹੀਆਂ ਹਨ ਅਤੇ ਯੋਗ ਦੇ ਪ੍ਰੋਫੈਸਰ ਰੱਖ ਰਹੀਆਂ ਹਨ ਟਰੇਨਰ ਰੱਖੇ ਜਾ ਰਹੇ ਹਨ ਤਾਂ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਇਸਦਾ ਬੜਾ ਚੰਗਾ ਅਤੇ ਸਾਂ ਸ਼ਾਨਦਾਰ ਪ੍ਰਭਾਵ ਪੈਂਦਾ ਹੈ